ਹਾਂਜੀ ਅਸੀਂ ਸੋਚਦੇ ਹਾਂ ਕਿ ਟੀ ਵੀ ਅਤੇ ਔਨਲਾਈਨ 'ਤੇ ਵਧੇਰੇ ਮੁਫਤ ਵਿਦਿਆਇਕ ਸਮੱਗਰੀ ਉਪਲਬਧ ਕਰਵਾਉਣੀ ਜਾਣੀ ਚਾਹੀਦੀ ਹੈ ਜਿਵੇਂ ਕਿ ਡੀ ਡੀ ਨੈਸ਼ਨਲ ਚੈਨਲ ਬੱਚਿਆਂ ਨੂੰ ਪੜ੍ਹਾਉਣ ਵਿੱਚ ਮਦਦ ਕਰਦਾ ਹੈ ਨੈਸ਼ਨਲ ਜਿਓਗ੍ਰਾਫਿਕਲ ਸਿੰਪਲ ਹਿਸਟਰੀ ਅਕੈੱਡਮੀ ਗਿਆਨ ਅਤੇ ਵਾਈਟ ਬੋਰਡ ਗਿਆਨ ਅਜਿਹੇ ਚੈਨਲ ਦੁਆਰਾ ਸਾਡੇ ਬੱਚੇ ਮੁਫ਼ਤ ਪੜ੍ਹਦੇ ਹਨ ਬੱਚਿਆਂ ਨੂੰ ਦਿੱਕਤ ਨਹੀਂ ਪੈਂਦੀ ਜੇ ਘਰ ਘਰ ਨੂੰ ਨਾ ਸਮਝ ਆਉਣ ਘਰ ਵਿੱਚ ਬੈਠਿਆਂ ਨਾ ਸਮਝ ਆਉਣ ਤਾਂ ਉਹ ਯੂਟਿਊਬ 'ਤੇ ਔਨਲਾਈਨ ਸਮਝ ਸਕਦੇ ਹਨ ਨੀਚੇ ਦਿੱਤੇ ਹੋਏ ਨੰਬਰ 'ਤੇ ਫੋਨ ਕਰਕੇ ਵੀ ਸਮਝ ਸਕਦੇ ਹਨ